ਜੇਕਰ ਪੰਜਾਬ ਵਿੱਚ ਆਪਾਂ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਹੋ ਗਏ ਹਰਮ ਅੰਮ੍ਰਿਤਸਰ ਦੇ ਵਿੱਚ ਇੱਕ ਹੀ ਮੰਦਰ ਦੁਰਗਿਆਣਾ ਮੰਦਰ ਹੋ ਗਿਆ ਤਲਵੰਡੀ ਸਾਬੋਂ ਦੇ ਵਿੱਚ ਗੁਰਦੁਆਰਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਹੋ ਗਿਆ ਹੋਰ ਅਨੰਦਪੁਰ ਸਾਹਿਬ ਰੋਪੜ ਦੇ ਵਿੱਚ ਅਤੇ ਜਿੱਦਾਂ ਜਲੰਧਰ ਦੇ ਵਿੱਚ ਗੱਲ ਕਰੀਏ ਤਾਂ ਦੇਵੀ ਤਲਾਬ ਮੰਦਰ ਹੋ ਗਿਆ ਅਤੇ ਗੁਰਦਾਸਪੁਰ ਵਾਲੀ ਸਾਈਡ ਗੁਰੂ ਕੀ ਮਸੀਤ ਜੋ ਕਿ ਛੇਵੀਂ ਪਾਤਸ਼ਾਹੀ ਨੇ ਬਣਾਈ ਹਰਗੋਬਿੰਦਪੁਰਾ ਦੇ ਵਿੱਚ ਬਿਆਸ ਦੇ ਕਿਨਾਰੇ ਦੇ ਉੱਪਰ ਹੋ ਗਈ ਅ ਅਸੀਂ ਸਭ ਤੋਂ ਜੋ ਨਜ਼ਦੀਕ ਹੈ ਸਾਡੇ ਦਮਦਮਾ ਸਾਹਿਬ ਅਸੀਂ ਮਹੀਨੇ ਦੇ ਵਿੱਚ ਦੋ ਵਾਰ ਜਾਂ ਤਿੰਨ ਵਾਰ ਉੱਥੇ ਜਾਂਦੇ ਹਾਂ ਉੱਥੇ ਜਾ ਕੇ ਜੋ ਸਭ ਤੋਂ ਵਧੀਆ ਸਭ ਤੋਂ ਅਨੰਦਮਈ ਜੋ ਸਾਡਾ ਅਭਿਆਸ ਹੁੰਦਾ ਉਹ ਉੱਥੇ ਬੈਠ ਕੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੀਰਤਨ ਸੁਣਨਾ ਹੁੰਦਾ ਅਤੇ ਅਸੀਂ ਉਸ ਅਭਿਆਸ ਦਾ ਸਭ ਤੋਂ ਜ਼ਿਆਦਾ ਆਨੰਦ ਲੈਂਦੇ ਹਾਂ